ਮੇਰਾ ਪਸੰਦੀ ਦਾ ਕਲਾਕਾਰ ਸਤਿੰਦਰ ਸਰਤਾਜ ਸਨ ਕਿਉਂਕਿ ਉਹਨਾਂ ਦਾ ਗਾਉਣ ਦਾ ਤਰੀਕਾ ਉਨਾਂ ਦੇ ਡੂੰਘੇ ਅਰਥਾਂ ਵਾਲੇ ਸ਼ਬਦ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਦਿੰਦੇ ਨੇ ਉਨਾਂ ਦੀ ਲਿਖਤ ਵਿੱਚ ਸੰਸਕ੍ਰਿਤ ਫਾਰਸੀ ਗੁਰਮੁਖੀ ਪੰਜਾਬੀ ਹਰੇਕ ਹੀ ਭਾਸ਼ਾ ਦਾ ਲਹਿਜਾ ਸੁਣਨ ਵਿੱਚ ਮਿਲਦਾ ਹੈ ਜਿਸ ਕਰਕੇ ਉਹਨਾਂ ਦਾ ਸੰਗੀਤ ਮੈਨੂੰ ਬਹੁਤ ਹੀ ਪਸੰਦ ਹੈ ਉਹਨਾਂ ਦੇ ਸ ਗੀਤ ਸਾਡੇ ਮਨਾਂ ਨੂੰ ਨਵੇਂ ਤੋਂ ਨਵਾਂ ਸੁਨੇਹਾ ਦੇ ਕੇ ਜਾਂਦੇ ਨੇ ਨਵੇਂ ਤੋਂ ਨਵੀਂ ਸਮਝ ਸੋਚ ਬਖਸ਼ਿਸ਼ ਕਰਦੇ ਨੇ ਜਿਸ ਕਰਕੇ ਮੈਨੂੰ ਇਸ ਗਾਇਕ ਸਤਿੰਦਰ ਸਰਤਾਜ ਦਾ ਸੰਗੀਤ ਸੁਣਨਾ ਬਹੁਤ ਪਸੰਦ ਹੈ